ਸਰੀਰਿਕ ਕਸਰਤ ਅਤੇ ਯੋਗਾ ਵਿੱਚ ਬਹੁਤ ਅੰਤਰ ਹੁੰਦਾ ਹੈ ਸਰੀਰਕ ਕਸਰਤ ਥੋੜ੍ਹੇ ਦੇਰ ਦੀ ਸਟਰੈਚਿੰਗ ਜਾਂ ਆਪਣੇ ਹੱਥ ਪੈਰਾਂ ਨੂੰ ਕਿਸੇ ਵੀ ਤਰ੍ਹਾਂ ਹਿਲਾ ਲੈਣ ਨੂੰ ਕਹਿੰਦੇ ਹਨ ਜਦ ਕਿ ਯੋਗਾ ਇੱਕ ਪੂਰੀ ਵਿਧੀ ਹੈ ਅਤੇ ਯੋਗਾ ਵਿੱਚ ਹੋਰ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਸਰੀਰਿਕ ਕਸਰਤਾਂ ਹੁੰਦੀਆਂ ਹਨ ਇੱਕ ਤਰ੍ਹਾਂ ਵੇਖਿਆ ਜਾਵੇ ਤਾਂ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਕੀਤੀਆਂ ਜਾਣ ਵਾਲੀਆਂ ਸਰੀਰਿਕ ਕਸਰਤਾਂ ਯੋਗਾ ਦਾ ਹੀ ਇੱਕ ਛੋਟਾ ਜਿਹਾ ਹਿੱਸਾ ਹੁੰਦੀਆਂ ਹਨ ਸਰੀਰਿਕ ਕਸਰਤ ਸਾਡੇ ਇਸ ਥੋੜ੍ਹੇ ਟਾਈਮ ਲਈ ਸਾਡੇ ਸਰੀਰ ਦੀ ਕਿਸੀ ਚੀਜ਼ ਨੂੰ ਸਹੀ ਕਰ ਸਕਦੀਆਂ ਹਨ ਪਰ ਯੋਗਾ ਉਹਨਾਂ ਹੀ ਚੀਜ਼ਾਂ ਨੂੰ ਸਾਰੀ ਉਮਰ ਲਈ ਸਹੀ ਕਰਨ ਦੀ ਸਮਰੱਥਾ ਰੱਖਦਾ ਹੈ